ਮੈਂ ਸੁਬਹਾ ਚਾਰ ਵਜੇ ਉੱਠਦੀ ਹਾਂ ਅਤੇ ਆਪਣਾ ਪਾਠ ਪੂਜਾ ਕਰਦੀ ਹਾਂ ਸਾਡਾ ਸਾਰਾ ਪਰਿਵਾਰ ਪਾਠ ਪੂਜਾ ਕਰਦਾ ਹੈ ਮੈਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਗਲੀ ਮਹੱਲੇ ਨੂੰ ਵੀ ਸ਼ਿਕਸ਼ਾ ਦਿੰਦੀ ਹਾਂ ਕਿ ਸਾਨੂੰ ਪਾਠ ਪੂਜਾ ਕਰਨਾ ਚਾਹੀਦਾ ਹੈ ਪਾਠ ਪੂਜਾ ਨਾਲ ਸਾਡੇ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਪਾਠ ਪੂਜਾ ਨਾਲ ਸਾਡੇ ਘਰ ਵਿੱਚ ਬਰਕਤਾਂ ਬਣਿਆ ਰਹਿੰਦੇ ਹਨ ਪਾਠ ਕਰਨ ਨਾਲ ਕੋਈ ਦੁੱਖ ਦਲਿੱਦਰ ਨਹੀਂ ਆਉਂਦਾ ਸਾਨੂੰ ਹਰ ਇੱਕ ਇਨਸਾਨ ਨੂੰ ਪਾਠ ਕਰਨਾ ਚਾਹੀਦਾ ਹੈ ਮੈਂ ਸ਼ਾਮ ਨੂੰ ਵੀ ਪਾਠ ਕਰਕੇ ਹੀ ਕੋਈ ਕੰਮ ਦੀ ਸ਼ੁਰੂਆਤ ਕਰਦੀ ਹਾਂ ਸੁਬਹਾ ਵੀ ਪਾਠ ਕਰਕੇ ਫਿਰ ਕੋਈ ਕੰਮ ਦੀ ਸ਼ੁਰੂਆਤ ਕਰਦੀ ਹਾਂ ਇਸ ਲਈ ਪਾਠ ਕਰਨ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਅਤੇ ਦੁੱਖ ਕਲੇਸ਼ ਦੂਰ ਰਹਿੰਦੇ ਹਨ ਦੁਖ ਕਲੇਸ਼ ਦੂਰ ਰਹਿਣ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਇਸ ਲਈ ਸਾਨੂੰ ਪਾਠ ਕਰਨਾ ਬਹੁਤ ਜ਼ਰੂਰੀ ਹੈ ਪਾਠ ਨਾਲ ਹਰ ਇੱਕ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ ਪਾਠ ਕਰਨ ਨਾਲ ਸਾਡਾ ਮਨ ਪਵਿੱਤਰ ਰਹਿੰਦਾ ਹੈ ਅਤੇ ਬੁਰਾ ਕਰਮ ਕੰਮਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ ਪਾਠ ਕਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਪਾਠ ਕਰਨ ਨਾਲ ਸਾਡਾ ਹਰ ਇਕ ਕੰਮ ਬਹੁਤ ਸਹੀ ਢੰਗ ਨਾਲ ਹੋ ਜਾਂਦਾ ਹੈ ਅਤੇ ਪਾਠ ਕਰਨ ਨਾਲ ਸਾਨੂੰ ਆਪਣੇ ਘਰ ਵਿੱਚ ਪਵਿੱਤਰਤਾ ਮਿਲਦੇ ਹੈ ਪਾਠ ਕਰਕੇ ਮੇਰਾ ਮਨ ਬਹੁਤ ਸ਼ਾਂਤ ਰਹਿੰਦਾ ਹੈ ਇਸ ਲਈ ਸਾਨੂੰ ਪਾਠ ਕਰਨਾ ਬਹੁਤ ਜ਼ਰੂਰੀ ਹੈ ਪਾਠ ਕਰਕੇ ਮੈਨੂੰ ਹਰ ਟਾਈਮ ਪਾਠ ਕਰਨ ਨਾਲ ਸੁੱਖ ਸ਼ਾਂਤੀ ਮਿਲਦੀ ਹੈ ਮੈਂ ਸੁਬਾਹ ਵੀ ਪਾਠ ਕਰਕੇ ਆਪਣੇ ਕੰਮ ਦੀ ਸ਼ੁਰੂਆਤ ਕਰਦੀ ਹਾਂ ਸ਼ਾਮ ਨੂੰ ਵੀ ਪਾਠ ਕਰਕੇ ਕੰਮ ਦੀ ਸ਼ੁਰੂਆਤ ਕਰਦੀ ਹਾਂ ਚੁਣੌਤੀਆਂ ਜਦੋਂ ਸਾਡਾ ਪਾਠ ਵਿੱਚ ਧਿਆਨ ਨਹੀਂ ਲੱਗਦਾ ਤਾਂ ਸਾਡੇ ਕੰਮਾਂ ਵੱਲ ਧਿਆਨ ਜਾਂਦਾ ਹੈ ਇਸ ਲਈ ਇਹ ਚੁਨੌਤਿਆਂ ਹੋ ਜਾਂਦੀਆਂ ਪਰ ਉਸ ਮਨ ਨੂੰ ਆਪਾ ਨੂੰ ਇਕਾਗਰ ਕਰਕੇ ਪਾਠ ਵਿੱਚ ਲਾਉਣਾ ਚਾਹੀਦਾ ਹੈ